ਹਾਂਜੀ ਅਸੀਂ ਮੰਨਦੇ ਹਾਂ ਕਿ ਅੱਜ ਕੱਲ੍ਹ ਜ਼ਿਆਦਾ ਸਕਰੀਨਾਂ ਦੇਖਣ ਕਾਰਨ ਬੱਚੇ ਆ ਜਿਹੜੇ ਉਹ ਗੇਮਾਂ ਨਹੀਂ ਖੇਡਦੇ ਬੱਚਿਆਂ ਦਾ ਜੋ ਰੁਝਾਨ ਆ ਉਹ ਗੇਮਾਂ ਵੱਲ ਅੱਜ ਕੱਲ੍ਹ ਬਿਲਕੁਲ ਵੀ ਨਹੀਂ ਰਿਹਾ ਕਿਉਂਕਿ ਬੱਚਿਆਂ ਦੇ ਮਾਂ ਬਾਪ ਨੂੰ ਅਕਸਰ ਇਹ ਲਾਲਚ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਫੋਨ ਦਾ ਲਾਲਚ ਦੇ ਕੇ ਜਾਂ ਯੂਟੀਊਬ 'ਤੇ ਵੀਡੀਓਜ਼ ਲਗਾ ਕੇ ਆਪਣਾ ਕੰਮ ਕਰਦੇ ਰਹਿੰਦੇ ਹਨ ਤਾਂ ਕਿ ਬੱਚੇ ਉਹਨਾਂ ਨੂੰ ਤੰਗ ਨਾ ਕਰਨ ਬਟ ਉਹ ਇਹ ਚੀਜ਼ ਨਹੀਂ ਦੇਖ ਰਹੇ ਕਿ ਬੱਚਿਆਂ ਨੂੰ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਬੱਚੇ ਅੱਜ ਕੱਲ੍ਹ ਆਪਣੀ ਜਿਹੜੀ ਸੇਮ ਏਜ ਦੇ ਬੱਚੇ ਨੇ ਉਹਨਾਂ ਨਾਲ ਵੀ ਖੇਡਣਾ ਪਸੰਦ ਨਹੀਂ ਕਰਦੇ ਉਹ ਜ਼ਿਆਦਾਤਰ ਆਪਣਾ ਸਮਾਂ ਜਿਹੜਾ ਉਹ ਫੋਨ 'ਤੇ ਯੂਸ ਕਰਦੇ ਹਨ ਜ਼ਿਆਦਾਤਰ ਫੋਨ 'ਤੇ ਗੇਮਾਂ ਖੇਡਦੇ ਹਨ ਵੱਧ ਤੋਂ ਵੱਧ ਵੀਡੀਓਜ ਦੇਖਦੇ ਹਨ ਕਾਰਟੂਨ ਦੇਖਦੇ ਹਨ ਜਿਨ੍ਹਾਂ ਕਾਰਨ ਜਿਹੜਾ ਉਹਨਾਂ ਦਾ ਧਿਆਨ ਉਹ ਸਟਡੀ ਵੱਲ ਵੀ ਨਹੀਂ ਰਹਿੰਦਾ ਅੱਜ ਕੱਲ੍ਹ ਦੇ ਬੱਚਿਆਂ ਜੋ ਪੜ੍ਹਾਈ ਵੱਲ ਵੀ ਧਿਆਨ ਨਹੀਂ ਦਿੰਦੇ ਉਹ ਜ਼ਿਆਦਾਤਰ ਫੋਨ ਦੇਖਣਾ ਪਸੰਦ ਕਰਦੇ ਹਨ ਬੱਚਿਆਂ ਦੇ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਨੂੰ ਫੋਨਾਂ ਦਾ ਲਾਲਚ ਨਾ ਦੇਣ ਜਦਕਿ ਇਹੋ ਜਿਹੀਆਂ ਕੁਛ ਜਿਹੜੀਆਂ ਐਕਟੀਵਿਟੀਜ਼ ਉਹ ਕਰਵਾਉਣ ਜਿਨ੍ਹਾਂ ਕਾਰਨ ਬੱਚਿਆਂ ਦਾ ਜੋ ਹੈ ਦਿਮਾਗੀ ਤੌਰ 'ਤੇ ਜੋ ਹੈ ਬੱਚੇ ਇੰਨੇ ਕੁ ਤਿਆਰ ਹੋ ਜਾਣ ਕਿ ਉਹ ਸਿਰਫ਼ ਨਾ ਕਿ ਫੋਨ ਯੂਜ ਕਰਨ ਜਦਕਿ ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇਣ ਅਤੇ ਆਪਣੀਆਂ ਕੁਛ ਇਸ ਤਰ੍ਹਾਂ ਦੀਆਂ ਐਕਟੀਵਿਟੀ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਜਿਹੜੇ ਨਾਲ ਦੇ ਬੱਚੇ ਆ ਉਹਨਾਂ ਨਾਲ ਮਿਲ ਵਰਤ ਕੇ ਰਹਿਣ ਉਹਨਾਂ ਨਾਲ ਖੇਡਣ ਉਹਨਾਂ ਨਾਲ ਇਕੱਠੇ ਰਹਿਣ ਤਾਂ ਕਿ ਉਹਨਾਂ ਵਿੱਚ ਆਪਸੀ ਪ੍ਰੇਮ ਪਿਆਰ ਆ ਜੋ ਬਣਿਆ ਰਹੇ